ਮੇਰੇ ਮਨਪਸੰਦ ਪੰਜਾਬੀ ਸ਼ਬਦ ਜਾਂ ਵਾਕਾਂਸ਼ ਇਹ ਹੇਠਲੇ ਹਨ ਜਿੱਦਾਂ ਕਿ ਮੈਂ ਆਪਣੇ ਦੋਸਤਾਂ ਯਾਰਾਂ ਨੂੰ ਬੈਠੇ ਹੋਈਏ ਤਾਂ ਕਹਿ ਦਿੰਦੇ ਹਾਂ ਉਹ ਚਾਚਾ ਜੀ ਇੱਧਰ ਆਓ ਗੱਲ ਸੁਣੋ ਉਹ 'ਚ ਕੀ ਹੁੰਦਾ ਹੈ ਕਿ ਅਗਲੇ ਨੂੰ ਵੀ ਬੁਰਾ ਨਹੀਂ ਲੱਗਦਾ ਕਿਉਂਕਿ ਉਹ ਸਾਡੀ ਯਾਰੀ ਦੋਸਤੀ ਹੁੰਦੀ ਹੈ ਅਤੇ ਅਗਲਾ ਕਦੀ ਉਸ ਚੀਜ਼ ਨੂੰ ਗਲਤ ਤਰੀਕੇ ਨਹੀਂ ਲੈਂਦਾ ਛੋਟੇ ਬੱਚਿਆਂ 'ਚ ਵੀ ਅਸੀਂ ਕਾਕਾ ਕਹਿ ਦਿੰਦੇ ਹਾਂ ਕਾਕਾ ਜੀ ਇੱਧਰ ਆਓ ਕਾਕਾ ਜੀ ਇੱਧਰ ਬੈਠੋ ਤਾਂ ਕਿ ਉਹ ਸਾਡੀ ਗੱਲ ਬੜੀ ਧਿਆਨ ਨਾਲ ਸੁਣਨ ਅਤੇ ਸਾਡੀ ਗੱਲ ਮੰਨਣ ਜਿੱਦਾਂ ਕਿ ਬੱਚੇ ਕਿਸੇ ਵਲੇ ਰੋਟੀ ਵਗੈਰਾ ਨਹੀਂ ਖਾਂਦੇ ਤਾਂ ਉਹਨਾਂ ਨੂੰ ਪਿਆਰ ਨਾਲ ਨਵੇਂ ਨਵੇਂ ਨਾਂ ਲੈ ਕੇ ਬੋਲਣਾ ਪੈਂਦਾ ਹੈ ਉਸੇ ਤਰ੍ਹਾਂ ਬੱਚਿਆਂ ਨੂੰ ਕਹਿ ਦੀ ਦੇ ਨਾਣੇ ਪੁੱਤਰ ਇੱਧਰ ਆ ਬੈਠ ਰੋਟੀ ਖਾ ਲੈ ਸਿਹਤ ਬਣੇਗੀ ਇਹ ਚੀਜ਼ਾਂ ਮੈਨੂੰ ਕਿਸੇ ਨਾਲ ਸ਼ੇਅਰ ਕਰਦੀਆਂ ਚੰਗੇ ਲੱਗਦੇ ਹਨ ਕਿਉਂਕੀ ਇਹ 'ਚ ਆਪਣੇ ਪਿਆਰ ਨਾਲ ਰਹਿਣ ਵਾਲੇ ਲੋਕ ਜਾਂ ਯਾਰ ਦੋਸਤ ਹਨ ਉਹ ਕਦੀ ਵੀ ਬੁਰਾ ਨਹੀਂ ਮੰਨਦੇ ਅਤੇ ਨਾਲੇ ਉਹ ਵੀ ਸਾਨੂੰ ਇਸੇ ਤਰ੍ਹਾਂ ਦੇ ਨਾਂ ਲੈ ਕੇ ਹੀ ਬੁਲਾਉਂਦੇ ਹਨ ਅਤੇ ਇਸ ਤਰ੍ਹਾਂ ਸਾਡਾ ਬੜਾ ਅੱਛਾ ਟਾਈਮ ਬਤੀਤ ਹੁੰਦਾ ਹੈ ਧੰਨਵਾਦ ਜੀ